ਪੰਜਾਬ ਦਾ ਸੱਭਿਆਚਾਰਕ ਵਿਰਸਾ ਸਾਰੇ ਦੇਸ਼ ਵਿੱਚ ਮਸ਼ਹੂਰ ਹੈ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਮਸ਼ਹੂਰ ਹੈ ਅਤੇ ਇਸ ਤ ਨੂੰ ਸਾਂਭਣ ਲਈ ਸਾਨੂੰ ਓ ਹਰ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲ ਸਕੀਏ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਆ ਸਾਨੂੰ ਉਹਨਾਂ ਨੂੰ ਆਪਣੇ ਪਿੰਡਾਂ 'ਚ ਲਿਜਾ ਕੇ ਉਹਨਾਂ ਨੂੰ ਉੱਥੇ ਦੀ ਕੰਮ ਕਾਰ ਕਿੱਤੇ ਉਹ ਕਿਵੇਂ ਰਹਿੰਦੇ ਹਨ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਕਿਵੇਂ ਹੈ ਸਾਨੂੰ ਉਹ ਉਸ ਤਰ੍ਹਾਂ ਨਾਲ ਆਪਣੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜ ਕੇ ਰੱਖਣਾ ਚਾਹੀਦਾ ਆਪਣੇ ਵਿਰਸੇ ਦੀਆਂ ਹਰ ਚੀਜ਼ਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ ਯਾਨੀ ਕਿ ਪਿੰਡਾਂ ਚ ਅੱਜ ਕੱਲ੍ਹ ਬੱਚਿਆਂ ਨੂੰ ਇਹ ਕੁਛ ਨਹੀਂ ਪਤਾ ਕਿ ਸਾਡੇ ਪਿੰਡਾਂ 'ਚ ਪਹਿਲਾਂ ਕਿਵੇਂ ਘਰ ਦੇ ਚਰਖੇ ਹੁੰਦੇ ਸੀ ਚੱਕੀਆਂ ਹੁੰਦੀਆਂ ਸੀ ਦਰੀਆਂ ਬੁਣਨੀਆਂ ਸੀ ਓ ਉਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਨਿਆਣ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜੋੜ ਕੇ ਰੱਖਣਾ ਚਾਹੀਦਾ ਸਾਨੂੰ ਉਹਨਾਂ ਨੂੰ ਆਪਣੇ ਸੱਭਿਆਚਾਰਿਕ ਪ੍ਰੋਗਰਾਮਾਂ 'ਤੇ ਲਿਜਾਣਾ ਚਾਹੀਦਾ ਸਾਨੂੰ ਆਪਣੇ ਵਿਰਸੇ ਦੇ ਜਿੰਨੇ ਵੀ ਗਿੱਧੇ ਭੰਗੜੇ ਹਨ ਉਹ ਨਿਆਣਿਆਂ ਨੂੰ ਸਿਖਾਉਣੇ ਚਾਹੀਦੇ ਹਨ ਅਤੇ ਆਪ ਵੀ ਆਪਣੇ ਘਰ ਵਿੱਚ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਆਪਣੇ ਸੱਭਿਆਚਾਰ ਨੂੰ ਦਰਸਾਉਂਦੀਆਂ ਹਨ ਉਹ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਵਿਕਸਿਤ ਕਰਨ ਲਈ ਉਹ ਉਹ ਕਲਾ ਉਹਨਾਂ ਨੂੰ ਹੀ ਹੋਬੀ ਬਣਾ ਕੇ ਉਹਨਾਂ ਨੂੰ ਆਪਾਂ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਸੱਭਿਆਚਾਰ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਆਪਣੇ ਬੱਚੇ ਆਪਣੀ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਯਾਦ ਰੱਖ ਸਕੇ ਅਤੇ ਅਸੀਂ ਆਪਣਾ ਵਿਰਸਾ ਸਾਂਭ ਕੇ ਰੱਖੀਏ ਨਾ ਕੀ ਅਸੀਂ ਬਾਹਰ ਦੇ ਲੋਕਾਂ ਨੂੰ ਦੇਖ ਕੇ ਉਹਨਾਂ ਵਾਂਗ ਆਪਣੇ ਵਿਰਸੇ ਨੂੰ ਭੁਲਾਈਏ